ਦੇਖੋ ਰਾਜ ਸਰਕਾਰ ਵਾਸਤੇ ਵੀ ਵਾਦਾਂ ਨੂੰ ਅਲੱਗ ਅਲੱਗ ਸ਼੍ਰੇਣੀਆਂ ਵਿੱਚ ਪਹਿਲੇ ਵੰਡਿਆ ਜਾਂਦਾ ਹੈ ਕੁਝ ਐਸੀਆਂ ਸ਼੍ਰੇਣੀਆਂ ਨੇ ਜਿਹੜੇ ਬਿਨਾਂ ਕਿਸੇ ਕਾਨੂੰਨੀ ਵਿਵਸਥਾ ਤੋਂ ਜਿਵੇਂ ਕਿ ਕੋਟ ਕਚਹਿਰੀਆਂ ਤੋਂ ਇਲਾਵਾ ਹੱਲ ਨਹੀਂ ਕੀਤੇ ਜਾ ਸਕਦੇ ਇਸ ਤੋਂ ਇਲਾਵਾ ਕਈ ਆਪਸੀ ਮਨ ਮੁਟਾਵ ਦੇ ਜਿਹੜੇ ਮੁੱਦੇ ਨੇ ਉਹ ਪਬਲਿਕ ਕੋਰਟਸ ਦੇ ਨਾਲ ਜਿਹਦੇ ਵਿੱਚ ਲੋਕ ਅਦਾਲਤਾਂ ਲਗਾ ਕੇ ਜਾਂ ਇਹਦੇ ਵਿੱਚ ਅਸੀਂ ਇੰਟਰਮੀਡੀਏਟਰ ਜਿਵੇਂ ਡਿਪਟੀ ਕਮਿਸ਼ਨਰ ਵੱਲੋਂ ਕੋਈ ਨੁਮਾਇੰਦਾ ਜਿਹੜਾ ਉਹ ਵਿੱਚ ਪੇਸ਼ ਕਰ ਦਿੱਤਾ ਪਾ ਦਿੱਤਾ ਜਾਂਦਾ ਜਿਹੜਾ ਦੋਨਾਂ ਧਿਰਾਂ ਨੂੰ ਆਪਸ 'ਚ ਬਿਠਾ ਕੇ ਇੱਕ ਦੂਜੇ ਦੇ ਨਾਲ ਸਲਾਹ ਕਰਾ ਕੇ ਮੁੱਦਾ ਜਿਹੜਾ ਆ ਉਹਨੂੰ ਖਤਮ ਕਰਦੇ ਨੇ ਇਹਨਾਂ ਤੋਂ ਇਲਾਵਾ ਅਗਰ ਕੋਈ ਜ਼ਮੀਨ ਝਗੜੇ ਦੇ ਮਾਮਲੇ ਨੇ ਜਿਹੜੇ ਦਰਜ ਨੇ ਕੋਟ ਕਚਹਿਰੀਆਂ ਦੇ ਵਿੱਚ ਜਾਂ ਕੋਈ ਆਪਸੀ ਮਨ ਮੁਟਾਵ ਦੇ ਨੇ ਉਹਨਾਂ ਵਾਸਤੇ ਜਿਹੜੀ ਸੰਬੰਧਿਤ ਚੁਣੀ ਹੋਈ ਨੁਮਾਇੰਦਗੀ ਹੈ ਪਿੰਡ ਦੀ ਜਿਵੇਂ ਸਰਪੰਚ ਹੋ ਗਏ ਜਾਂ ਪੰਚਾਇਤ ਹੋ ਗਈ ਜਾਂ ਕਿਸੇ ਕਸਬੇ ਦੀ ਜਿਵੇਂ ਮਿਊਂਸਪਲ ਕੌਂਸਲ ਹੋ ਗਈ ਉਹਨਾਂ ਦੇ ਮੈਂਬਰਾਂ ਨੂੰ ਵਿੱਚ ਪਾ ਕੇ ਕਮੇਟੀ 'ਚ ਬਿਠਾ ਕੇ ਡਿਪਟੀ ਕਮਿਸ਼ਨਰ ਆਪ ਜਾਂ ਉਹਨਾਂ ਦਾ ਚੁਣਿਆ ਹੋਇਆ ਕੋਈ ਨੁਮਾਇੰਦਾ ਵਿੱਚ ਬੈਠ ਕੇ ਉਹ ਜਿਹੜੇ ਮਸਲੇ ਆ ਉਹ ਸੁਲਝਾ ਦਿੰਦੇ ਆ ਇਸ ਤੋਂ ਇਲਾਵਾ ਬਹੁਤ ਤਰ੍ਹਾਂ ਦੇ ਅ ਜਿਹੜੇ ਅ ਅਵੇਅਰਨੈਸ ਕੈਂਪਸ ਨੇ ਜਿਹੜੇ ਜਾਗਰੂਕਤਾ ਫੈਲਾਉਣ ਵਾਲੇ ਕੈਂਪ ਨੇ ਉਹ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲਗਾਏ ਜਾਂਦੇ ਨੇ ਤਾਂ ਕਿ ਲੋਕਾਂ ਨੂੰ ਮੁੱਦਿਆਂ ਦੀ ਜਾਣਕਾਰੀ ਹੋਵੇ ਔਰ ਕੋਈ ਵੀ ਉਹਨਾਂ ਨੂੰ ਮਿਸਗਾਈਡ ਕਰਕੇ ਕੋਈ ਨਜਾਇਜ਼ ਫਾਇਦਾ ਨਾ ਚੁੱਕ ਸਕੇ ਧੰਨਵਾਦ